ਮੇਰੇ ਕੋਲ ਮੇਰੇ ਖਾਣੇ ਨੂੰ ਵੱਧ ਸਵਾਦ ਬਣਾਉਣ ਲਈ ਇੱਕ ਤਕਨੀਕ ਹੈ ਕਿ ਮੈਂ ਉਹਦੇ 'ਚ ਦੇਸੀ ਘਿਓ ਦਾ ਚਮਚ ਪਾ ਦਿੰਦਾ ਚਾਹੇ ਉਹ ਦਾਲ ਹੋਵੇ ਜਾਂ ਕੋਈ ਹੋਰ ਸਬਜ਼ੀ ਹੋਵੇ ਮੈਂ ਉਹ 'ਚ ਉਹ ਪਾ ਦਿੰਦਾ ਅਤੇ ਉਹਦੇ ਨਾਲ ਜਿਹੜਾ ਖਾਣਾ ਹੈ ਸਵਾਦ ਵੀ ਹੋ ਜਾਂਦਾ ਹੈ ਅਤੇ ਘਿਓ ਵੀ ਖਾਇਆ ਜਾਂਦਾ ਘਿਓ ਜਿਹੜਾ ਸਾਨੂੰ ਪਤਾ ਪੰਜਾਬੀਆਂ ਦੀ ਖੁਰਾਕ ਦਾ ਇੱਕ ਸਭ ਤੋਂ ਵੱਡਾ ਇੰਗਰੀਡੀਅਨਟ ਹੈ ਅਤੇ ਮੈਂ ਉਹ 'ਚ ਉਹ ਪਾ ਲੈਂਦਾ ਹੁੰਦਾ ਮੈਂ ਮਸਾਲੇ ਘੱਟ ਹੀ ਰੱਖਦਾ ਹੁੰਦਾ ਤਾਂ ਵੀ ਮੇਰਾ ਖਾਣਾ ਜਿਹੜਾ ਹੈਗਾ ਉਹ ਸਵਾਦ ਬਣਦਾ ਬਾਕੀ ਜਦੋਂ ਮੈਂ ਕੁਝ ਖਾਣਾ ਪਕਾ ਰਿਹਾ ਹੁੰਦਾ ਤਾਂ ਮੈਂ ਜਿਹੜੀ ਗੈਸ ਹੈ ਉਹਨੂੰ ਸਿਮ 'ਤੇ ਰੱਖਦਾਂ ਤਾਂ ਕਿ ਚੀਜ਼ ਆਰਾਮ ਨਾਲ ਪੱਕੇ ਅਤੇ ਵਧੀਆ ਪੱਕੇ ਹੋਰ ਤਾਂ ਮੇਰੇ ਕੋਲ ਕੋਈ ਤਕਨੀਕ ਨਹੀਂ ਹੈ ਬਸ ਮੈਂ ਮਸਾਲੇ ਜਿਹੜੇ ਨੇ ਘੱਟ ਰੱਖਦਾਂ ਅਤੇ ਆਮ ਘਰਾਂ ਦੇ ਮਸਾਲੇ ਹੀ ਵਰਤਦਾਂ ਕੋਈ ਜ਼ਿਆਦਾ ਮਸਾਲੇ ਨਹੀਂ ਪਾਉਂਦਾ ਜਾ ਜਾਂ ਜ਼ਿਆਦਾ ਮਿਰਚਾਂ ਨਹੀਂ ਪਾਉਂਦਾ